ਫਤਿਹਗੜ੍ਹ ਸਾਹਿਬ ਪੰਜਾਬ ਦਾ ਇੱਕ ਪ੍ਰਮੁੱਖ ਜ਼ਿਲ੍ਹਾ ਹੈ ਜਿਸ ਜੋ ਕਿ ਪੰਜਾਬ ਜਿਵੇਂ ਕਿ ਪੰਜਾਬ ਦੇ ਦ ਦੇ ਅਧਿਕਤਰ ਰੁਜ਼ਗਾਰ ਖੇਤੀਬਾੜੀ 'ਤੇ ਨਿਰਭਰ ਹਨ ਉਵੇਂ ਹੀ ਫਤਿਹਗੜ੍ਹ ਸਾਹਿਬ ਦੇ ਵਿੱਚ ਖੇਤੀਬਾੜੀ ਹੁੰਦੀ ਹੈ ਅਤੇ ਕੁਝ ਕੁ ਉਦਯੋਗ ਇਸਦੇ ਨੇੜੇ ਲੱਗਦੇ ਹਨ ਜਿਵੇਂ ਕਿ ਮੰਡੀ ਗੋਬਿੰਦਗੜ੍ਹ ਜਿੱਥੇ ਦੇ ਕਾਰਖਾਨੇ ਇਸ ਦੀ ਇਸ ਦੇ ਵਿੱਚ ਸਹਾਇਕ ਹਨ ਰੁਜ਼ਗਾਰ ਕਰਨ ਦੇ ਵਿੱਚ ਅਤੇ ਫਤਿਹਗੜ੍ਹ ਸਾਹਿਬ ਇਤਿਹਾਸਿਕ ਜਗ੍ਹਾ ਹੈ ਜਿੱਥੇ ਕਿ ਦੋ ਪ੍ਰਮੁੱਖ ਗੁਰਦੁਆਰੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਹਨ ਜਿੱਥੇ ਕਿ ਲੋਕ ਦਰਸ਼ਨ ਕਰਨ ਲਈ ਸੇਵਾ ਕਰਨ ਲਈ ਆਉਂਦੇ ਹਨ ਅਤੇ ਗੁਰੂ ਦਾ ਅਟੁੱਟ ਲੰਗਰ ਵੀ ਛਕਦੇ ਹਨ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਅਧਿਕਤਰ ਫੈਲੀ ਹੋਈ ਹੈ ਜਿਵੇਂ ਕਿ ਜਿਵੇਂ ਕਿ ਪੰਜਾਬ ਦੀ ਜ਼ਿਆਦਾਤਰ ਸੰਖਿਆ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਉਵੇਂ ਹੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੇ ਜ਼ਿਲ੍ਹਾ ਦੇ ਵਿਦਿਆਰਥੀ ਵੀ ਬਾਹਰ ਦੀ ਵੱਲ ਕੂਚ ਕਰ ਰਹੇ ਹਨ ਅਤੇ ਜਿਸ ਨੂੰ ਪ੍ਰਮੁੱਖ ਰੱਖਦਿਆਂ ਕਿ ਇਸ ਇੱਥੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪ੍ਰਮੁੱਖ ਪੜ੍ਹਾਈ ਦੇ ਪੜ੍ਹਾਈ ਦੇ ਇੰਸਟੀਟਿਊਟ ਵੀ ਬਣਾਏ ਗਏ ਹਨ ਜੋ ਕਿ ਯੂਨੀਵਰਸਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਟੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲੇਜ ਹੈ ਅਤੇ ਸ਼੍ਰੀ ਮਾਤਾ ਗੁਜਰੀ ਜੀ ਕੋਲੇਜ ਵੀ ਹੈ ਜਿੱਥੋਂ ਕਿ ਵਿਦਿਆਰਥੀ ਆਪਣੀ ਆਪਣੀ ਰੁਚੀ ਦੇ ਹਿਸਾਬ ਨਾਲ ਐਡਮਿਸ਼ਨ ਲੈ ਕੇ ਉੱਥੇ ਤੋਂ ਸਿੱਖਿਆ ਪ੍ਰਾਪਤ ਕਰ ਸਕਦੇ ਹਨ ਅਤੇ ਵਧੀਆ ਨੌਕਰੀਆਂ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ ਇੱਥੇ ਲੋਕ ਸਰਕਾਰੀ ਅਤੇ ਨਿਜੀ ਕੰਮ ਵੀ ਕਰਦੇ ਹਨ ਸਰਕਾਰੀ ਇੱਥੇ ਇੱਥੇ ਕਚਹਿਰੀਆਂ ਵੀ ਹਨ ਅਤੇ ਨੇੜੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਨੌਕਰੀਆਂ ਕਰਦੇ ਹਨ ਅਤੇ ਨਿਜੀ ਕੰਮਾਂ ਲਈ ਇੱਥੋਂ ਦੇ ਆਪਣੇ ਆਪਣੀ ਦੁਕਾਨਾਂ ਦੇ ਵਿੱਚ ਵੀ ਕੰਮ ਕਰਦੇ ਹਨ ਅਤੇ ਬੇਰੁਜ਼ਗਾਰੀ ਲਈ ਸਾਡਾ ਇਹ ਸੁਝਾਅ ਹੈ ਕਿ ਇੱਥੋਂ ਦੇ ਵਿੱਚ ਇੱਥੋਂ ਤੋਂ ਵਿੱਦਿਆ ਲੈ ਕੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਕਰਕੇ ਸਰਕਾਰੀ ਨੌਕਰੀ ਲਈ ਉਪਰਾਲਾ ਕਰਨਾ ਚਾਹੀਦਾ ਹੈ ਅਤੇ ਜਿਸ ਤੋਂ ਸਰਕਾਰੀ ਨੌਕਰੀ ਦਾ ਨਹੀਂ ਹੁੰਦਾ ਅਤੇ ਜਿੰਨਾਂ ਖਰਚਾ ਆਪਾਂ ਬਾਹਰ ਜਾਣ ਦੇ ਵਿੱਚ ਲਗਾ ਦਿੰਦੇ ਹਾਂ ਅਤੇ ਉਨਾਂ ਖਰਚਾ ਕਰਕੇ ਆਪਾਂ ਇੱਥੇ ਹੀ ਆਪਣਾ ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹਾਂ ਧੰਨਵਾਦ